ਹਾਂਜੀ ਸਾਨੂੰ ਰੋਟੀ ਬਣਾਉਣ ਦੀ ਆਫ਼ਤ ਆਈ ਹੈ ਪਰ ਅਸੀਂ ਉਹਨੂੰ ਆਫ਼ੀ ਆਫ਼ਤ ਨਹੀਂ ਸਮਝਦੇ ਕਿਉਂਕਿ ਉਹ ਤਾਂ ਸਾਨੂੰ ਸਾਡੇ ਸਰੀਰ ਲਈ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਹੋਣ ਕਰਕੇ ਸਾਡੇ ਮੇਰੇ ਬੱਚੇ ਔਰ ਮਿਸਿਜ਼ ਆਪਣੇ ਛੁੱਟੀਆਂ ਕੱਟਣ ਲਈ ਪੇਕੇ ਘਰ ਚਲੇ ਜਾਂਦੇ ਨੇ ਅਤੇ ਉਹਦੇ ਬਾਅਦ ਰੋਟੀ ਸਾਨੂੰ ਆਪ ਬਣਾਉਣੀ ਪੈਂਦੀ ਆ ਅਤੇ ਰੋਟੀ ਬਣਾਉਣ ਦਾ ਆਨੰਦ ਵੀ ਬਹੁਤ ਆਉਂਦਾ ਕਿਉਂਕਿ ਅਸੀਂ ਕਦੇ ਕਿਤੇ ਬਣਾਉਣੀ ਹੁੰਦੀ ਆ ਅਤੇ ਰੋਟੀ ਬਣਾਉਣ ਦਾ ਬਹੁਤ ਮਜ਼ਾ ਆਉਂਦਾ ਹੈ ਨਾਲ਼ੇ ਅਸੀਂ ਆਪਣੇ ਤਰੀਕੇ ਨਾਲ਼ ਬਣਾਉਂਦੇ ਹਾਂ ਟੇਢੀਆਂ ਮੇਢੀਆਂ ਵੀ ਬਣਦੀਆਂ ਰੋਟੀਆਂ ਕਦੇ ਕਿਤੇ ਤਾਂ ਉਹ ਵੀ ਸਾਨੂੰ ਠੀਕ ਲੱਗਦੀਆਂ ਹਨ ਅਤੇ ਸਵਾਦ ਵੀ ਲੱਗਦੀਆਂ ਹਨ ਅਤੇ ਰੋਟੀ ਬਣਾਉਣ 'ਚ ਬਹੁਤ ਮਜ਼ਾ ਵੀ ਆਉਂਦਾ ਹੈ ਕਿਉਂ ਕਦੇ ਕਿਤੇ ਬਣਾਉਣੀ ਪੈਂਦੀ ਹੈ ਰੋਟੀ ਅਤੇ ਖੁਸ਼ੀ ਖੁਸ਼ੀ ਬਣਾਉਂਦੇ ਹਾਂ ਰੋਟੀ ਇਹਦੇ ਵਿੱਚ ਕੋਈ ਆਫ਼ਤ ਵਾਲੀ ਗੱਲ ਨਹੀਂ ਹੈਗੀ ਸਾਨੂੰ ਆਪਣੇ ਸਰੀਰ ਲਈ ਅਤੇ ਰੋਟੀ ਤਾਂ ਬਣਾਉਣੀ ਹੀ ਪੈਣੀ ਆ ਅਤੇ ਹੋਰ ਵੀ ਪਕਾਉਣ ਲਈ ਸਬਜ਼ੀ ਵਗੈਰਾ ਬਣਾਉਣ ਲਈ ਵੀ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਅਸੀਂ ਪਹਿਲੇ ਵੀ ਕਈ ਵਾਰ ਸਬਜ਼ੀ ਸੁਬਜ਼ੀ ਆਪ ਬਣਾਈ ਆ ਅਤੇ ਰੋਟੀਆਂ ਵੀ ਆਪ ਪਕਾਈਆਂ ਹਨ ਇਸ ਕਰਕੇ ਕੋਈ ਆਫ਼ਤ ਵਾਲੀ ਗੱਲ ਨਹੀਂ ਹੈਗੀ ਬਹੁਤ ਸਹੀ ਤਰੀਕੇ ਨਾਲ਼ ਬਣਾ ਲੈਂਦੇ ਹਾਂ ਅਸੀਂ ਕਦੇ ਕਿਤੇ ਬਾਹਰ ਵੀ ਸਾਨੂੰ ਇਕੱਲਿਆਂ ਜਾਣਾ ਪੈਂਦਾ ਅਤੇ ਉੱਥੇ ਵੀ ਅਸੀਂ ਆਪ ਹੀ ਰੋਟੀ ਬਣਾਉਂਦੇ ਹਾਂ ਆਪ ਹੀ ਸਭ ਬਣਾਉਂਦੇ ਹਾਂ ਅਤੇ ਬਾਹਰ ਜਾ ਕੇ ਰੋਟੀ ਬਣਾਉਣ ਦਾ ਸਵਾਦ ਹੀ ਸਾਨੂੰ ਵੱਖਰਾ ਆਉਂਦਾ ਹੈ ਔਰ ਆਨੰਦ ਮਿਲਦਾ ਹੈ ਬਹੁਤ ਸਹੀ ਢੰਗ ਨਾਲ਼ ਬਣਾਉਂਦੇ ਹਾਂ ਅਤੇ ਚੰਗਾ ਲੱਗਦਾ ਹੈ ਸਾਨੂੰ